ਹਾਂਜੀ ਸਤਿ ਸ਼੍ਰੀ ਅਕਾਲ ਜੀ ਲਿਕੁਅਰ ਸ਼ੌਪ ਤਪਾ ਤੋਂ ਮੰਡੀ ਤੋਂ ਜੀ ਹਾਂਜੀ ਹਾਂਜੀ ਇਹ ਮਲਹੋਤਰਾ ਐਂਡ ਗਰੁਪਸ ਕੋਲ ਮਲਹੋਤਰਾ ਐਂਡ ਗਰੁਪਸ ਕੋਲ ਹੈ ਜੀ

ਹਾਂਜੀ ਐਤਕੀ ਸਰ ਜਿਹੜੇ ਟੈਂਡਰ ਨੇ ਉਹਨਾਂ ਦਾ ਰੇਟ ਹੀ ਬਹੁਤ ਜ਼ਿਆਦਾ ਹਾਈ ਹੋਇਆ ਪਹਿਲੀ ਗੱਲ ਤਾਂ ਹਾਂਜੀ ਨੰਬਰ ਦੂਜੀ ਗੱਲ ਹੁਣ ਮਨੂਫੈਕਚਰਿੰਗ ਕੋਸਟ ਦੇ ਵਿੱਚ ਵੀ ਵਾਧਾ ਹੋ ਗਿਆ ਕਿਉਂਕਿ ਹੁਣ ਤੁਸੀਂ ਗੁੜ ਦੇ ਰੇਟ ਹੀ ਲਾ ਲਓ ਕਿੰਨਾ ਹੋਇਆ ਪਿਆ ਜਿਹੜਾ ਅਠਾਈ ਤੀਹ ਰੁਪਏ ਸੀਗਾ ਉਹ ਹੁਣ ਪੰਜਾਹ ਪਲੱਸ ਹੈ ਅਤੇ ਉਹਦੇ ਨਾਲ ਫਿਰ ਤੁਹਾਨੂੰ ਪਤਾ ਮਨੂਫੈਕਚਰਿੰਗ ਕੋਸਟ ਵੀ ਵੱਧ ਗਈ ਕੁਛ ਟੈਂਡਰ ਜ਼ਿਆਦਾ ਮਹਿੰਗਾ ਹੋਣ ਕਰਕੇ ਐਕਸਾਈਜ਼ ਡਿਊਟੀ ਵੱਧ ਗਈ ਹਾਂਜੀ ਹਾਂਜੀ ਅਤੇ ਉਹਦੇ ਕਰਕੇ ਬਸ

ਨਹੀਂ ਨਹੀਂ ਨਹੀਂ ਵੱਧ ਘੱਟ ਤਾਂ ਦੇਖੋ ਜੀ ਜਿਵੇਂ ਕੋਈ ਕਰਿੰਦਾ ਇਕੱਲਾ ਹੋਵੇ ਉਹ ਪੰਜ ਦਸ ਵੀਹ ਰੁਪਈਏ ਵੱਧ ਲੈਜੇ ਤਾਂ ਅੱਡ ਗੱਲ ਹੈ ਬਾਕੀ ਜਿਹੜਾ ਰੇਟ ਹੈ ਉਹ ਤਾਂ ਹੈਗਾ ਹੀ ਹੈਗਾ ਹਾਂਜੀ ਹਾਂਜੀ ਹਾਂਜੀ ਹਾਂ ਇਹ ਤਾਂ ਹੈ ਹਾਂਜੀ ਹਾਂਜੀ ਇਹ ਤਾਂ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ